ਮੈਂ ਸਨੇਹਾ ਕੁਮਾਰੀ ਹਾਂ ਅਤੇ ਮੈਂ ਤਰਨ ਤਾਰਨ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਆਵਾਜਾਈ ਦੇ ਬਹੁਤ ਸਾਰੇ ਵਿਕਲਪ ਉਪਲਬਧ ਹਨ ਜਿਵੇਂ ਕਿ ਟਰੇਨਸ ਕੈਬਸ ਬੱਸਾਂ ਆਦਿ ਬਹੁਤ ਸਾਰੇ ਟੈਕਨੋਲੋਜੀ ਵਾਲੇ ਸਾਧਨ ਉਪਲਬਧ ਹਨ ਜਿਨ੍ਹਾਂ ਤੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਨ ਨਿਊ ਟੈਕਨੋਲੋਜੀ ਦੇ ਕਾਰਨ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਬਹੁਤ ਜਲਦੀ ਜਾ ਸਕਦੇ ਹਨ ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਪੈਡਲ ਵਾਲੇ ਰਿਕਸ਼ੇ ਹੁੰਦੇ ਸੀ ਉਹ ਬਹੁਤ ਜ਼ਿਆਦਾ ਸਮਾਂ ਲਗਾਉਂਦੇ ਸੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਵਾਸਤੇ ਮਗਰ ਹੁਣ ਨਿਊ ਟੈਕਨੋਲੋਜੀ ਦੇ ਕਾਰਨ ਜਿਵੇਂ ਕਿ ਈ ਰਿਕਸ਼ਾਸ ਆ ਗਏ ਹਨ ਅਗਰ ਕਿਸੇ ਨੂੰ ਬਜ਼ਾਰ ਜਾਣਾ ਹੋਵੇ ਜਾਂ ਕਿਸੇ ਦੇ ਘਰ ਜਾਣਾ ਹੋਵੇ ਇਹ ਸਾਡੀ ਮਦਦ ਕਰਦੇ ਹਨ ਤਰਨ ਤਾਰਨ ਜ਼ਿਲ੍ਹੇ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਹੁਣ ਇੱਥੇ ਟਰੇਨਸ ਵੀ ਚਲਦੀਆਂ ਹਨ ਪੁਰਾਣੇ ਸਮਿਆਂ ਵਿੱਚ ਇੱਥੇ ਟ੍ਰੇਨਸ ਵੀ ਨਹੀਂ ਚਲਦੀਆਂ ਸਨ ਸਾਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ ਟ੍ਰੇਨਸ ਲੈਣ ਵਾਸਤੇ ਜਾਂ ਕਿਤੇ ਹੋਰ ਥਾਂ 'ਤੇ ਜਾਣ ਵਾਸਤੇ ਮਗਰ ਹੁਣ ਕੈਬਸ ਵੀ ਚੱਲ ਪਈਆਂ ਹਨ ਇਸ ਸਾਧਨ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਮਿਲੀ ਹੈ ਅਤੇ ਇਹ ਬਹੁਤ ਵਧੀਆ ਹੈ ਕਿ ਸਾਡਾ ਤਰਨ ਤਾਰਨ ਸ਼ਹਿਰ ਬਹੁਤ ਜ਼ਿਆਦਾ ਤਰੱਕੀ ਵਿੱਚ ਹੈ ਅਤੇ ਆਵਾਜਾਈ ਦੇ ਵਿਕਲਪ ਵੀ ਹਨ ਕਈਆਂ ਕੋਲ ਆਪਣੇ ਖੁਦ ਦੇ ਵਿਕਲਪ ਨਾ ਹੋਣ ਦੇ ਕਾਰਨ ਇਹ ਵਿਕਲਪ ਬਹੁਤ ਜ਼ਿਆਦਾ ਸਹਾਇਕ ਹਨ